ਜੀ ਹਾਂ ਟੈਕਨੋਲੋਜੀ ਦੇ ਆਉਣ ਨਾਲ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਵਧੀ ਹੈ ਟੈਕਨੋਲੋਜੀ ਜਿਸ ਪ੍ਰਕਾਰ ਆਈ ਹਨ ਏ ਸੀ ਟੀ ਵੀ ਫਰਿਜ ਕੋਈ ਵੀ ਪੱਖੇ ਇਹਨਾਂ ਨੇ ਸਾਡੀ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਵਧਾ ਦਿੱਤੀਆਂ ਹਨ ਲੋਕ ਅੱਜ ਕੱਲ੍ਹ ਗਰਮੀਆਂ 'ਚ ਏ ਸੀ ਯੂਜ ਕਰਦੇ ਹਨ ਜੋ ਕਿ ਪੁਰਾਣੇ ਜ਼ਮਾਨੇ ਵਿੱਚ ਬਣਿਆ ਹੀ ਨਹੀਂ ਸੀਗਾ ਜੀ ਹਾਂ ਇਹ ਟੈਕਨੋਲੋਜੀ ਦੇ ਕਾਰਨ ਹੀ ਹੋਇਆ ਹੈ ਪਰ ਟੈਕਨੋਲੋਜੀ ਨੇ ਸਾਡੀ ਖਪਤ ਬਿਜਲੀ ਦੀ ਬਹੁਤ ਵਧਾਤੀ ਹੈ ਬਿਜਲੀ ਦੇ ਬਿਲ ਲੋਕਾਂ ਦੇ ਬਹੁਤ ਜ਼ਿਆਦਾ ਆ ਰਹੇ ਹਨ ਜਿਸ ਕਾਰਨ ਲੋਕ ਪੈਸਾ ਬਚਾ ਨਹੀਂ ਰਹੇ ਹਨ ਪਰ ਪੈਸੇ ਦੀ ਫਾਲਤੂ ਦੀ ਖਪਤ ਕਰ ਰਹੇ ਹਨ ਸਾਨੂੰ ਟੈਕਨੋਲੋਜੀ ਦਾ ਪ੍ਰਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਜਿਸ ਪ੍ਰਕਾਰ ਸਾਡਾ ਫਰਿੱਜ ਚੱਲਦਾ ਹੈ ਗਰਮੀਆਂ 'ਚ ਬਿੱਲ ਆਉਂਦੇ ਹਨ ਜੀ ਹਾਂ ਗਰਮੀਆਂ 'ਚ ਫਰਿੱਜ ਚਲਾਉਣਾ ਜ਼ਰੂਰੀ ਹੈ ਕਿਉਂਕਿ ਸਾਰਾ ਸਮਾਨ ਖਰਾਬ ਹੋ ਜਾਂਦਾ ਹੈ ਪਰੰਤੂ ਅਗਰ ਸਰਦੀਆਂ ਵਿੱਚ ਉਹੀ ਸਮਾਨ ਆਪਾਂ ਬਾਹਰ ਰੱਖ ਦੀਏ ਤਾਂ ਉਹ ਨਹੀਂ ਖਰਾਬ ਹੋਵੇਗਾ ਉਹ ਇੱਕਦਮ ਠੀਕ ਰਹੇਗਾ ਤਾਂ ਸਾਨੂੰ ਟੈਕਨੋਲੋਜੀ ਦਾ ਪ੍ਰਯੋਗ ਕਰਨਾ ਇਮਪੋਰਟੈਂਟ ਹੈ ਜ਼ਰੂਰੀ ਹੈ ਪਰੰਤੂ ਆਪਾਂ ਸਾਨੂੰ ਇਹ ਟਰਾਈ ਕਰਨਾ ਚਾਹੀਦਾ ਹੈ ਕਿ ਆਪਾਂ ਟੈਕਨੋਲੋਜੀ ਦਾ ਘੱਟ ਤੋਂ ਘੱਟ ਇਸਤੇਮਾਲ ਕਰੀਏ ਤਾਂ ਕਿ ਉਹ ਆਉਣ ਵਾਲੀ ਪੀੜ੍ਹੀਆਂ ਵਾਸਤੇ ਵੀ ਰਹੇ ਕਿਉਂਕਿ ਜਿਸ ਜਿਸ ਪ੍ਰਕਾਰ ਆਪਾਂ ਆਪਣਾ ਸਾਰਾ ਕੁਛ ਯੂਜ ਕਰਦੇ ਹਨ ਉਸ ਪ੍ਰਕਾਰ ਸਾਨੂੰ ਲੱਗ ਰਿਹਾ ਹੈ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਵੇਗੀ